ਲੋਕ ਗੀਤ ਪੰਜਾਬੀਆਂ ਦੇ ਰੋਮ ਰੋਮ ਵਿੱਚ ਰਚੇ ਹੋਏ ਹਨ ਉਹਨਾਂ ਦਾ ਕੋਈ ਅਜਿਹਾ ਮੌਕਾ ਨਹੀਂ ਜਿੱਥੇ ਲੋਕ ਗੀਤ ਨਾ ਗਾਏ ਜਾਂਦੇ ਹੋਣ ਪੰਜਾਬੀ ਲੋਕ ਗੀਤ ਪੰਜਾਬੀ ਜੀਵਨ ਅਤੇ ਸੱਭਿਆਚਾਰ ਦਾ ਦਰਪਣ ਹਨ ਪੰਜਾਬ ਦੇ ਲੋਕਾਂ ਦੀ ਇਹ ਆਤਮਾ ਹਨ ਪੰਜਾਬ ਦੇ ਲੋਕ ਗੀਤ ਪੰਜਾਬੀ ਲੋਕ ਸਾਹਿਤ ਦਾ ਪ੍ਰਮੁੱਖ ਅੰਗ ਹਨ ਪੰਜਾਬ ਦਾ ਲੋਕ ਜੀਵਨ ਇਹਨਾਂ 'ਚ ਧੜਕਦਾ ਸਾਫ ਨਜ਼ਰ ਆਉਂਦਾ ਹੈ ਇਹਨਾਂ 'ਚ ਐਨੀ ਵੰਨ ਸੁਵੰਨਤਾ ਹੈ ਕਿ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਪੰਜਾਬੀ ਵਿੱਚ ਲੋਕ ਗੀਤ ਨਾ ਮਿਲਦੇ ਹੋਣ ਇਹ ਨਜ਼ਾਰਾ ਹੀ ਗਿਣਤੀ ਵਿੱਚ ਹਨ ਪੰਜਾਬੀ ਆਪਣਾ ਸਾਰਾ ਜੀਵਨ ਹੀ ਨੱਚਦੇ ਗਾਉਂਦੇ ਬਤੀਤ ਕਰਦੇ ਹਨ ਇਸ ਕਰਕੇ ਹਰ ਪੰਜਾਬੀ ਤੁਹਾਨੂੰ ਖੁਸ਼ੀਆਂ ਵੰਡਦਾ ਖਿੜੇ ਮੱਥੇ ਮਿਲੇਗਾ ਹੁਣ ਮੈਂ ਆਪਣਾ ਮਨਪਸੰਦ ਦਾ ਲੋਕ ਗੀਤ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੀ ਹਾਂ ਓ ਰੱਤੀ ਤੇਰੀ ਵੇ ਢੋਲ ਮੇਰਿਆ ਲੂੰਗੀ ਓਏ ਵੱਟ ਪਵਾਉਂਦੀ ਆ ਮੈਂ ਰੇਸ਼ਮ ਦੀਆਂ ਡੋਰਾਂ ਵੇ ਕੋਈ ਆਉਂਦਾ ਜਾਂਦਾ ਹੋਏ ਵੇ ਕੋਈ ਆਉਂਦਾ ਜਾਂਦਾ ਹੋਏ ਵੇ ਕੋਈ ਆਉਂਦਾ ਜਿਉਂਦਾ ਅੱਖੋਂ ਓਹਲੇ ਹੋ ਗਿਆ ਵੇ ਕੋਈ ਆਉਂਦਾ ਜਾਂਦਾ ਅੱਖੋਂ ਓਹਲੇ ਹੋ ਗਿਆ ਵੇ ਮੈਂ ਦੂਰ ਤੋਂ ਪਛਾਣ ਦੀ ਆਂ ਡੋਰਾਂ ਈ ਓਏ ਹੋ ਹੋ ਮਾਹੀ ਮੇਰੇ ਨੇ ਗੁਠਲੀ ਦਿੱਤੀ ਵਿੱਚ ਗੁਠਲੀ ਦੇ ਕੋਕਾ ਮਾਹੀ ਮੇਰੀ ਨੇ ਗੁਠਲੀ ਦਿੱਤੀ ਵਿੱਚ ਗੁਠਲੀ ਦੇ ਕੋਕਾ ਵਾਅਦਾ ਕਰਕੇ ਉਮਰਾਂ ਦਾ ਮੈਨੂੰ ਵਿੱਚ ਹੀ ਦੇ ਗਿਆ ਧੋਖਾ ਰੱਤੀ ਤੇਰੀ ਰੱਤੀ ਤੇਰੀ ਰੱਤੀ ਤੇਰੀ ਵੇ ਢੋਲ ਮੇਰਿਆਂ ਲੂੰਗੀ ਓਏ ਵੱਟ ਪਵਾਉਂਦੀ ਆਂ ਮੈਂ ਰੇਸ਼ਮ ਦੀਆਂ ਡੋਰਾਂ ਵੇ ਕੋਈ ਆਉਂਦਾ ਜਾਂਦਾ ਹੋਏ ਵੇ ਕੋਈ ਆਉਂਦਾ ਜਿਊਂਦਾ ਅੱਖੋਂ ਓਹਲੇ ਹੋ ਗਿਆ ਵੇ ਕੋਈ ਆਉਂਦਾ ਜਿਊਂਦਾ ਅੱਖੋਂ ਓਹਲੇ ਹੋ ਗਿਆ ਵੇ ਮੈਂ ਦੂਰ ਤੋਂ ਪਛਾਣਦੀ ਆਂ ਡੋਰਾਂ ਈ ਓਏ ਧੰਨਵਾਦ